ਹਾਲ ਹੀ 'ਚ ਮੈਂ ਫੇਸਬੁੱਕ ਟਵੀਟਰ ਅਤੇ ਇੰਨਸਟਾਗ੍ਰਾਮ ਬਹੁਤ ਹੀ ਜ਼ਿਆਦਾ ਤਰੀਕੇ ਨਾਲ਼ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਇਹ ਜਿਹੜਾ ਸਾਡਾ ਮਨ ਪਰਚਾਵੇ ਦਾ ਬੜਾ ਵਧੀਆ ਸਾਧਨ ਹੈ ਜਦ ਵੀ ਸਾਡੇ ਕੋਲ ਟਾਈਮ ਹੁੰਦਾ ਹੈ ਆਪਾਂ ਇਸ ਤੋਂ ਚੀਜ਼ਾਂ ਸਿੱਖ ਵੀ ਸਕਦੇ ਹਾਂ ਵੈਸੇ ਤਾਂ ਬਹੁਤ ਹੀ ਜਿਹੜੀ ਦੁਨੀਆਂ ਦੀ ਖ਼ਬਰਾਂ ਹਨ ਸਾਨੂੰ ਇੱਥੋਂ ਸਿੱਖਣ ਨੂੰ ਮਿਲਦੀਆਂ ਹੈ ਜੋ ਵੀ ਦੁਨੀਆਂ 'ਚ ਚੱਲ ਰਿਹਾ ਹੈ ਲੋਕ ਕੀ ਪਸੰਦ ਕਰ ਰਹੇ ਹਨ ਲੋਕ ਕੀ ਨਹੀਂ ਪਸੰਦ ਕਰ ਰਹੇ ਹਨ ਦੁਨੀਆ 'ਚ ਕੀ ਚੱਲ ਰਿਹਾ ਹੈ ਹਾਲ ਹੀ 'ਚ ਜਿਵੇਂ ਇੱਕ ਰਸ਼ੀਆ ਅਤੇ ਯੂਕਰੇਨ ਦਾ ਯੁੱਧ ਚੱਲ ਰਿਹਾ ਸੀ ਉਸ ਤਰੀਕੇ ਦੀ ਖ਼ਬਰਾਂ ਵੀ ਸਾਨੂੰ ਸੋਸ਼ਲ ਮੀਡੀਆ ਤੋਂ ਬਹੁਤ ਹੀ ਜਲਦੀ ਮਿਲ ਜਾਂਦੀਆਂ ਅਤੇ ਜੇ ਤੁਸੀਂ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਸੋਸ਼ਲ ਮੀਡੀਆ ਨੂੰ ਸਟੋਕ ਮਾਰਕਿਟ ਲਈ ਯੂਜ਼ ਕਰਦਾ ਹਾਂ ਕਿਉਂਕਿ ਸਟੋਕ ਮਾਰਕਿਟ ਤੋਂ ਸਾਨੂੰ ਆਪਾਂ ਲੋਕਾਂ ਦੇ ਦਿਮਾਗ ਦੇ ਜਿਹੜੇ ਫੰਡਾਮੈਂਟਲ ਹੈ ਅਤੇ ਸਾਈਕੋਲੋਜੀ ਲੈਵਲ ਦੀਆਂ ਚੀਜ਼ਾਂ ਹਨ ਆਪਾਂ ਉਸਨੂੰ ਸਮਝ ਸਕਦੇ ਹਾਂ ਅਤੇ ਆਪਾਂ ਸਟੋਕ ਮਾਰਕਿਟ ਤੋਂ ਆਪਣਾ ਜਿਹੜਾ ਕੁੱਛ ਥੋੜ੍ਹਾ ਬਹੁਤ ਜਿਹੜਾ ਪ੍ਰੋਫਿੱਟ ਹੈ ਉਹ ਕਮਾ ਸਕਦੇ ਹਾਂ ਸੋਸ਼ਲ ਮੀਡੀਆ ਦੀ ਜੇ ਆਪਾਂ ਪਸੰਦ ਜਾਂ ਨਾਪਸੰਦੀਦਾ ਗੱਲ ਦੀ ਜੇ ਮੈਂ ਗੱਲ ਕਰਾਂ ਤਾਂ ਇੱਕ ਜਿਹੜੀ ਬਹੁਤ ਹੀ ਵਧੀਆ ਲੱਗਦੀ ਹੈ ਕਿ ਇਹ ਬਹੁਤ ਹੀ ਛੇਤੀ ਤਰੀਕੇੇ ਨਾਲ਼ ਬਹੁਤ ਹੀ ਘੱਟ ਪੈਸੇ ਨਾਲ਼ ਤੁਹਾਨੂੰ ਖਬਰਾਂ ਪਹੁੰਚਾ ਦਿੰਦਾ ਹੈ ਅਤੇ ਤੁਹਾਨੂੰ ਸਿੱਖਣ ਨੂੰ ਵੀ ਬਹੁਤ ਕੁੱਛ ਮਿਲਦਾ ਹੈ ਪਰ ਜਿਹੜੀ ਇੱਕ ਬਹੁਤ ਬੁਰੀ ਗੱਲ ਲੱਗਦੀ ਹੈ ਕਿ ਇਹਦੇ ਅੰਦਰ ਜਿਹੜੀ ਕੁੱਝ ਬੁਰੀ ਖ਼ਬਰਾਂ ਹੈ ਉਹਨਾਂ ਨੂੁੰ ਵੀ ਬਹੁਤ ਹੀ ਜ਼ਿਆਦਾ ਤਰੀਕੇ ਅਤੇ ਬੁਰੇ ਤਰੀਕੇ ਨਾਲ਼ ਦਿਖਾਇਆ ਜਾਂਦਾ ਹੈ ਜੋ ਕਿ ਇੱਕ ਬਹੁਤ ਹੀ ਗਲਤ ਗੱਲ ਹੈ